ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਸ ਜੀ ਵਧੀਆ ਕਿਰਪਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਮਤਲਬ ਕਿਹੜੇ ਕਾਲਜ ਬਾਰੇ ਪ੍ਰਾਈਵੇਟ ਸਰਕਾਰੀ ਕਿਹੜੇ ਸਰਕਾਰੀ ਕਿਹੜੀ ਸਟਰੀਮ ਬੀ ਕੌਮ ਤੁਹਾਨੂੰ ਮਿਲ ਜਾਊਗਾ ਜੀ ਸਰਕਾਰੀ 'ਚ ਐਸ ਡੀ ਕਾਲਜ ਵੈਲਿਊ ਆ ਔਰ ਆਪਣਾ ਗੌਰਮੈਂਟ ਕਾਲਜ ਮਿਲ ਜਾਊਗਾ ਡੀ ਏ ਵੀ ਕਾਲਜ ਮਿਲ ਜਾਊਗਾ ਕਈ ਕਾਲਜ ਆ ਤਿੰਨ ਚਾਰ ਜਿਹੜੇ ਵਧੀਆ ਸਰਕਾਰੀ ਵਾਲੇ ਜੈਗੁਅਨ ਫੀਸ ਤਾਂ ਜੀ ਦੇਖੋ ਗੌਰਮੈਂਟ ਕਾਲਜ ਤਾਂ ਸਸਤੀ ਹੋਣੀ ਉਹ ਤਾਂ ਤਿੰਨ ਚਾਰ ਹਜ਼ਾਰ ਹੀ ਹੋਣੀ ਮੇਰੇ ਹਿਸਾਬ ਨਾਲ ਮੈਨੂੰ ਐਗਜੈਕਟਲੀ ਨਹੀਂ ਪਤਾ ਬਾਕੀਆਂ ਦੀ ਵੀ ਨੇੜੇ ਤੇੜੇ ਹੋਣੀ ਇਨੇ ਕਦੇ ਡੀ ਏ ਵੀ ਕਾਲਜ ਆ ਤੁਹਾਡਾ ਪੈ ਜਾਂਦਾ ਜੀ ਚੰਡੀਗੜ੍ਹ ਰੋਡ ਤੇ ਇਸਲਾਮਾਬਾਦ ਪੈ ਜਾਂਦਾ ਡੀ ਏ ਵੀ ਕਾਲਜ ਐਸ ਟੀ ਕਾਲਜ ਤੁਹਾਡਾ ਜੀ ਪੈ ਜਾਂਦਾ ਵਾ ਆਹਾ ਐਸ ਡੀ ਕਾਲਜ ਦਾ ਮੈਨੂੰ ਪਤਾ ਰੇਲ ਮੰਡੀ ਦੇ ਲਾਗੇ ਛਾਗੇ ਆ ਮੈਨੂੰ ਪਤਾ ਗੌਰਮੈਂਟ ਕਾਲਜ ਪੈਂਦਾ ਜੀ ਗੋਰਮੈਂਟ ਕਾਲਜ ਚੌਂਕ ਪਹਿਲੀ ਰੋਡ ਤੇ ਪੁੱਛ ਲਈ ਉਹਨਾਂ ਨੂੰ ਦੱਸ ਦੇਣਾ ਗਵਰਨਮੈਂਟ ਕਾਲਜ ਵਾਲੇ ਕਰਲ ਪ੍ਰਾਈਵੇਟ ਹੈਗੇ ਭਾਅ ਜੀ ਜੀ ਐੱਨ ਏ ਹੈਗਾ ਇੱਕ ਤਾਂ ਹੋਰ ਆਪਣਾ ਇੱਕ ਰਿਆਤ ਬਾਹਰਾ ਵਾ ਅਗੇਨ ਜਿਹੜੇ ਪ੍ਰਾਈਵੇਟ ਹੈਗੇ ਆ ਇਹੀ ਆ ਮੇਨ ਤਾਂ ਾਂ ਦੀ ਇਹਨਾਂ ਦੀ ਦੇਖੋ ਜੀ ਮਹਿੰਗੀ ਹੋਣੀ ਤਾਂ ਲੱਖ ਰੁਪਏ ਨੂੰ ਹੋਣੀ ਸਾਲ ਅੰਦਾਜਾ ਮੇਰਾ ਹੋਸਟਲ ਹਾਂਜੀ ਹੈਗੇ ਆ ਜੀ ਨਹੀਂ ਹੋਸਟਲ ਦਾ ਕੋਲੀ ਨੇ ਪੀ ਜੀ ਵਗੈਰਾ ਤੁਹਾਡੇ ਦੂਰ ਮਿਲੂਗੀ ਹੋਸਟਲ ਤਾਂ ਕੋਲ ਹੀ ਹੁੰਦਾ ਰਿਆਤਬਾਰ ਆ ਤੁਹਾਡਾ ਪੈ ਜਾਂਦਾ ਜੀ ਚੰਡੀਗੜ੍ਹ ਰੋਡ ਤੇ ਪੈ ਜਾਂਦਾ ਡੀ ਏ ਵੀ ਕਾਲਜ ਤੋਂ ਅੱਗੇ ਜਾ ਕੇ ਕਿੰਨੇ ਕ ਰਿਆਦਬਾਰਾ ਵੀ ਆ ਆਪਣਾ ਜੀ ਐਨ ਏ ਵੀ ਇੰਜਨੀਅਰਿੰਗ ਕਰਾਉਂਦੇ ਆ ਤੇ ਹੋਰ ਸਵਾਮੀ ਸਰਵਰਨ ਗਿਰੀ ਕੈਂਪਸ ਸਰਕਾਰੀ ਚਾਪ ਪੀਓ ਕੈਂਪਸ ਜਿਹੜਾ ਸਰਵਨ ਗਿਰੀਸਾ ਨਹੀਂ ਨਹੀਂ ਗੌਰਮੈਂਟ ਕਾਲਜ 'ਚ ਚੀਜ਼ ਮਤਲਬ ਇੰਜੀਨੀਅਰਿੰਗ ਵਾਈਜ ਨਹੀਂ ਮਿਲਣਾ ਤੁਹਾਨੂੰ ਬੀ ਐਸ ਸੀ ਵਗੈਰਾ ਪ੍ਰਾਈਜ ਦੇਖੋ ਸਤਾ ਫੀਸ ਭਾਅ ਜੀ ਇੰਜੀਨੀਅਰਿੰਗ ਦੀ ਲੱਖ ਰੁਪਏ ਨੂੰ ਹੋਣੇ ਆ ਸਾਲ ਹਾਂਜੀ ਹਾਂਜੀ ਮੈਂ ਤਾਂ ਜੀ ਗਵਰਨਮੈਂਟ ਕਾਲਜ ਹਾਂਜੀ ਹਾਂਜੀ ਦੇਖੋ ਜੀ ਜਦੋਂ ਤੁਸੀਂ ਬਟ ਜੇ ਬੀ ਟੈਕ ਵਗੈਰਾ ਕਰਨੀ ਹ ਤਾਂ ਸਰਕਾਰੀ ਕਾਲਜ ਆ ਉਥੇ ਟਰਾਈ ਕਰੋ ਓਕੇ